ਹੈਲੋ ਫਲਿੱਪਕਾਰਟ ਮੈਂ ਤੁਹਾਡੇ ਕੋਲ ਇੱਕ ਰੈੱਡਮੀ ਦਾ ਫੋਨ ਆਰਡਰ ਕੀਤਾ ਸੀ ਜੋ ਕਿ ਮੈਨੂੰ ਮਿਲ ਗਿਆ ਹੈ ਸਭ ਤੋਂ ਪਹਿਲਾਂ ਗੱਲ ਇਹ ਕਿ ਇਹ ਬਹੁਤ ਲੇਟ ਆਇਆ ਇਸ ਦੀ ਡੇਟ ਦਿੱਤੀ ਸੀ ਤੁਸੀਂ ਵੀਹ ਤਰੀਕ ਪਰ ਇਹ ਮੇਰੇ ਕੋਲ਼ ਅੱਜ ਤੇਈ ਤਰੀਕ ਨੂੰ ਪਹੁੰਚ ਰਿਹਾ ਹੈ ਦੂਸਰੀ ਗੱਲ ਇਸ ਫੋਨ ਦੀ ਮੈਂ ਕਲਰ ਕੋਈ ਹੋਰ ਮੰਗਿਆ ਸੀ ਅਤੇ ਤੁਸੀਂ ਕੋਈ ਮੈਨੂੰ ਹੋਰ ਭੇਜ ਦਿੱਤਾ ਉਸ ਤੋਂ ਬਾਅਦ ਇਹ ਦੇ ਕੈਮਰੇ ਦੀ ਕੁਆਲਟੀ ਦੀ ਗੱਲ ਕਰਾਂ ਅਤੇ ਮੈਨੂੰ ਬਹੁਤ ਬੈਡ ਐਕਸਪੀਰੀਐਂਸ ਰਿਹਾ ਮੇਰਾ ਕੈਮਰਾ ਇਸ ਦੀ ਕੁਆਲਟੀ ਬਹੁਤ ਡਾਊਨ ਹੈ ਅਤੇ ਉਸਤੋਂ ਬਾਅਦ ਕੈਮਰਾ ਦੇ ਇਲਾਵਾ ਇਸ ਤੋਂ ਬਾਅਦ ਜਿਹੜੀ ਬੈਟਰੀ ਬੈਕਅੱਪ ਹੈ ਬੈਟਰੀ ਬੈਕਅੱਪ ਇਹਦਾ ਚਾਰ ਹਜ਼ਾਰ ਐੱਮ ਐੱਚ ਦੱਸਿਆ ਹੋਇਆ ਹੈ ਪਰ ਇਹ ਟਾਈਮ ਬਹੁਤ ਘੱਟ ਕੱਢ ਰਿਹਾ ਹੈ ਇਸ ਵਿੱਚ ਮੈਨੂੰ ਲੱਗਦਾ ਪੂਰੇ ਫੋਨ ਵਿੱਚ ਇਹ ਪ੍ਰੋਬਲਮ ਲੱਗ ਰਹੀ ਹੈ ਮੈਨੂੰ ਤੁਸੀਂ ਮੇਰਾ ਫੋਨ ਚੇਂਜ ਕਰੋ